ਹਾਂਜੀ ਜਿਵੇਂ ਤੁਸੀਂ ਪੁੱਛਿਆ ਕਿ ਪੰਜਾਬ ਵਿੱਚ ਕਿਹੜੇ ਪ੍ਰਮੁੱਖ ਧਾਰਮਿਕ ਗ੍ਰੰਥ ਜਾਂ ਗ੍ਰੰਥਾਂ ਦਾ ਪਾਲਣ ਕੀਤਾ ਗਿਆ ਹੈ ਵੈਸੇ ਤਾਂ ਪੰਜਾਬ ਵਿੱਚ ਸਾਰੇ ਧਰਮਾਂ ਨੂੰ ਹੀ ਬਰਾਬਰ ਧਾਰਮਿਕ ਗ੍ਰੰਥਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਗਿਆ ਹੈ ਕਿ ਸਾਰੇ ਧਰਮ ਆਪੋ ਆਪਣੇ ਆਪੋ ਆਪਣੇ ਧਰਮਾਂ ਵਿੱਚ ਹਨ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਸਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਹਨ ਇਸ ਵਿੱਚ ਦਸ ਗੁਰੂਆਂ ਦੀ ਬਾਣੀ ਰਚਿਤ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਇਹਦੇ ਵਿੱਚ ਚੌਦ੍ਹਾਂ ਸੌ ਉਣਹੱਤਰ ਤੋਂ ਲੈ ਕੇ ਸਤਾਰ੍ਹਾਂ ਸੌ ਅੱਠ ਤੱਕ ਸ ਸਿੱਖਾਂ ਦੀ ਰਚਿਤ ਅਤੇ ਇਕੱਠੀ ਬਾਣੀ ਹੈਗੀ ਆ ਉਦੋਂ ਬਾਅਦ ਹੈਗਾ ਵੈਦ ਵੈਦ ਆ ਜਿਹੜਾ ਸੰਸਕ੍ਰਿਤ ਦਾ ਸ਼ਬਦ ਹੈਗਾ ਉਦੋਂ ਬਾਅਦ ਹੈਗਾ ਕੁਰਾਨ ਇਹ ਇਸਲਾਮ ਦਾ ਪਵਿੱਤਰ ਪਾਠ ਹੈ ਜਿਸ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਬਾਈਬਲ ਇਸ ਵਿੱਚ ਪਰਮੇਸ਼ਵਰ ਤੇ ਉਸਦੀ ਸ੍ਰਿਸ਼ਟੀ ਦੇ ਲੋਕ ਆ ਜਿਹੜੇ ਨਾਲ ਰਿਸ਼ਤੇ ਦੀ ਕਹਾਣੀ ਆ ਜਿਹੜੀ ਦੱਸੀ ਗਈ ਹੈ ਇਸ ਤਰ੍ਹਾਂ ਪੰਜਾਬ ਵਿੱਚ ਸਾਰੇ ਧਾਰਮਿਕ ਗ੍ਰੰਥਾਂ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਧਰਮ ਦਿਤ ਦਿੱਤਾ ਗਿਆ ਹੈ